ਅੱਜ ਕੱਲ੍ਹ ਤਾਂ ਸੂਟਾਂ ਦੇ ਬਹੁਤ ਸੋਹਣੇ ਰੰਗ ਡਿਜ਼ਾਇਨ ਅਤੇ ਫੈਸ਼ਨ ਬਹੁਤ ਜ਼ਿਆਦਾ ਏ ਖ਼ਾਸ ਕਰ ਲੇਡੀਜ ਸੂਟਾਂ ਦੇ ਲਈ ਬਹੁਤ ਹੀ ਸੋਹਣੇ ਸੋਹਣੇ ਫੈਸ਼ਨ ਡਿਜ਼ਾਇਨ ਆਏ ਹੋਏ ਹਨ ਸੂਟ ਸੀਲਟ ਦਾ ਕੋਟਨ ਦਾ ਪਸ਼ਮੀਨੀ ਸੂਟ ਸੋਹਣੀ ਸੋਹਣੀ ਕਢਾਈਆਂ ਵਾਲੇ ਬਹੁਤ ਹੀ ਸੋਹਣੇ ਲੱਗਦੇ ਹਨ ਜਿਵੇਂ ਡਿਜ਼ਾਇਨ ਬੈਲ ਮਤਲਬ ਅੱਗੋਂ ਬਾਵਾਂ 'ਤੇ ਗਲਿਆਂ 'ਤੇ ਪੱਟੀ ਲੱਗਣੀ ਅਤੇ ਗੂੜੇ ਗੂੜੇ ਕਿੰਨੇ ਸੋਹਣੇ ਰੰਗ ਠੀਕ ਹੈ ਲੇਡੀ ਸੂਟਾਂ ਦੇ ਤਾਂ ਸੋਹਣੀ ਸੋਹਣੀ ਪਾਈਪਿੰਗ ਲੱਗਣੀ ਲੈਸ ਲੱਗਣੀ ਡਿਜ਼ਾਇਨ ਵਨ ਸੁਵੰਨੇ ਰੰਗ ਤਾਂ ਇੰਨੇ ਸੋਹਣੇ ਸੋਹਣੇ ਆਏ ਹੋਏ ਹਨ

ਜਿਵੇਂ ਕਿ ਅੰਬਰੇਲਿਆ ਵਾਲਾ ਸੂਟ ਫਰਾਕ ਵਾਲੇ ਸੂਟ ਪਜਾਮੀ ਸੂਟ ਪਜਾਮੇ ਵਾਲੇ ਸੂਟ ਪਲਾਜੋ ਵਾਲੇ ਸੂਟ ਤਾਂ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਹਨ ਪੈਰਲ ਵਾਲੇ ਪਲਾਜੋ ਵਾਲੇ ਜਾਂਫੇ ਵਾਲੇ ਸੂਟ ਲੇਡੀ ਸੂਟਾਂ ਦਾ ਤਾਂ ਬਹੁਤ ਹੀ ਸੋਹਣਾ ਫੈਸ਼ਨ ਆਇਆ ਹੋਇਆ ਹ ਬੱਚਿਆਂ ਦੀ ਸੋਹਣੇ ਸੋਹਣੇ ਕੁੜਤੀਆਂ ਜੈਂਟਸ ਸੂਟਾਂ ਦਾ ਵੀ ਬਹੁਤ ਸੋਹਣਾ ਰਿਵਾਜ਼ ਹੈ ਪੈਂਟ ਸਾਲਟ ਹੋ ਗਈ ਸੋਹਣਾ ਸੋਹਣਾ ਫੈਸ਼ਨ ਤਾਂ ਬਹੁਤ ਹੀ ਚੱਲਿਆ ਹੋਇਆ ਹੈ